ਸਾਡੇ ਘਰ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਆਪਣੇ ਬਚਪਨ 'ਚ ਦੇਖਿਆ ਜਿਹੜੇ ਬਲਬ ਹੁੰਦੇ ਸੀ ਦੂਜੇ ਫਲੋਰਸੈਂਟ ਬਲਬ ਹੁੰਦੇ ਸੀ ਜਿਹੜੇ ਕਿ ਬਿਜਲੀ ਦੀ ਜਿਹੜੀ ਵਰਤੋਂ ਜ਼ਿਆਦਾ ਕਰਦੇ ਜਿਸ ਕਰਕੇ ਜਿਸ ਕਰਕੇ ਬਿੱਲ ਜ਼ਿਆਦਾ ਆਉਂਦਾ ਸੀ ਅਤੇ ਹੁਣ ਉਹਦੀ ਬਦਲ ਅਸੀਂ ਮੈਂ ਆਪਣੇ ਘਰ 'ਚ ਦੇਖਦਾ ਕਿ ਐਲ ਈ ਡੀ ਬਲਬ ਆਉਂਦੇ ਆ ਉਹਦੀ ਕੰਜ਼ਪਸ਼ਨ ਘੱਟ ਗਰਮ ਘੱਟ ਹੁੰਦੇ ਫਿਊਜ ਘੱਟ ਹੁੰਦੇ ਅਤੇ ਉਹਦੀ ਮੈਂ ਕੋਸਟ ਅਫੈਸ ਐਫੀਸ਼ੈਂਟ ਆ ਮਤਲਬ ਉਹ ਮਤਲਬ ਕਿ ਜੇ ਆਪਾਂ ਬਹੁਤ ਭਾਰੀ ਵੀ ਨਹੀਂ ਪੈਂਦੇ ਇੱਕ ਵਾਰੀ ਅਸੀਂ ਇਨਵੈਸਟਮੈਂਟ ਕਰਦੇ ਘੱਟੋ ਘੱਟ ਸਾਲ ਦੋ ਸਾਲ ਤਿੰਨ ਸਾਲ ਆਰਾਮ ਨਾਲ ਕੱਢ ਦਿੰਦੇ ਉਹ ਮੈਕਸੀਮਮ ਦੋ ਸਾਲ ਤਾਂ ਕੱਢ ਹੀ ਦਿੰਦੇ ਉਹ ਅਤੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਪਹਿਲਾਂ ਗੈਸ ਚੁੱਲ੍ਹੇ ਹੁੰਦੇ ਤੇ ਸਾਡੇ ਘਰ ਚੁੱਲ੍ਹਾ ਹੁੰਦਾ ਲੱਕੜੀ ਬਾਲਣ ਵਾਲਾ ਉਹ ਆਪਾਂ ਗੈਸ ਚੁੱਲ੍ਹਿਆਂ ਦੀ ਵਰਤੋਂ ਹੋਣ ਲੱਗੀ ਉਹ ਇੱਕ ਨਵੀਂ ਟੈਕਨੋਲੋਜੀ ਉਛਾਲ ਤਾ ਬਹੁਤ ਜ਼ਿਆਦਾ ਫਾਇਦਾ ਹੋਇਆ ਪੋਲਿਊਸ਼ਨ ਘਟਿਆ ਉਸ ਚੀਜ਼ ਨਾਲ ਹੁਣ ਜਿਹੜੀ ਮੈਂ ਥੋ ਥੋੜ੍ਹੇ ਦਿਨ ਪਹਿਲਾਂ ਲੈ ਕੇ ਆਇਆ ਉਹ ਹੈਗਾ ਸੀਗਾ ਇਲੈਕਟ੍ਰਿਕ ਅਵਨ ਠੀਕ ਆ ਇਲੈਕਟ੍ਰਿਕ ਚੁੱਲ੍ਹਾ ਜਿਹਨੂੰ ਕਹਿ ਦਿੰਦੇ ਉਹਦੇ ਬਾਰੇ ਅਸੀਂ ਲਾ ਕੇ ਬਣਾ ਦਿੰਦੇ ਆ ਰੋਟੀ ਸਬਜ਼ੀ ਜੋ ਮਰਜ਼ੀ ਬਣਾਉਣਾ ਉਹ 'ਚ ਪਰੀ ਫੰਕਸ਼ਨ ਪਹਿਲੇ ਹੁੰਦੇ ਕਿ ਤੁਸੀਂ ਸੂਪ ਬਣਾਉਣਾ ਉਹਦੇ ਵੀ ਫੰਕਸ਼ਨ ਅਲੱਗ ਹੈ ਉੱਪਰ ਜਿਹੜਾ ਹੀਟ ਹੈ ਓਨੇ ਹਿਸਾਬ ਨਾਲ ਚੱਲਣੀ ਗਰਮੀ ਪੂਰੇ ਹਿਸਾਬ ਨੂੰ ਕਿਉਂਕਿ ਹੁਣ ਬਿਜਲੀ ਦੀਆਂ ਯੂਨਿਟਾਂ ਮਾਫ ਹੈ ਇਸ ਕਰਕੇ ਬੰਦਾ ਉਹੀ ਵਰਤੋਂ ਕਰਦਾ ਉਹਦੇ ਇਲਾਵਾ ਪਹਿਲਾਂ ਚਿੱਠੀਆਂ ਪਾਉਂਦੇ ਸੀ ਹੁਣ ਅਸੀਂ ਮੈਂ ਦੇਖਿਆ ਕਿ ਈਮੇਲਾਂ ਅਸੀਂ ਈਮੇਲ ਪਾ ਕੇ ਜਾਂ ਮੈਸੇਜ ਕਰਕੇ ਵਟਸਐਪ ਦੁਆਰਾ ਸਮਾਰਟਫੋਨ ਨਾਲ ਕੰਮ ਕਰ ਲੈਂਦੇ ਇੰਟਰਨੈਟ ਜਿਹੜਾ ਉਛਾਲ ਸਭ ਤੋਂ ਬੜੀ ਟਰਨੋਲਜੀ ਦਾ ਉਛਾਲ ਸੀਗਾ ਇੰਟਰਨੈਟ ਦੀ ਵਰਤੋਂ ਨਾਲ ਸਾਰਾ ਕੰਮ ਛੇਤੀ ਹੋ ਗਿਆ ਅਤੇ ਕੰਮ ਕਰਨਾ ਸੌਖਾ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹਨਾਂ ਬਾਰੇ ਅਸੀਂ ਗੱਲ ਕਰ ਸਕਦੇ ਹਾਂ